ਮੇਰਾ ਸ਼ੁਰੂ ਵਿੱਚ ਹੀ ਮੇਰਾ ਸ਼ੁਰੂ ਤੋਂ ਹੀ ਡਰੋਇੰਗ ਵਿੱਚ ਕਾਫ਼ੀ ਇਨਟਰੱਸਟ ਰਿਹਾ ਹੈ ਡਰੋਇੰਗ ਵਿੱਚ ਇਨਟਰੱਸਟ ਹੋਣ ਕਰਕੇ ਮੈਂ ਕਾਫ਼ੀ ਸਾਰੇ ਕੋਪੀਟੀਸ਼ਨ ਵਿੱਚ ਭਾਗ ਵੀ ਲੈਂਦੀ ਰਹੀ ਹਾਂ ਅਤੇ ਸਾ ਪਿਛਲੇ ਦਿਨਾਂ ਵਿੱਚ ਸਾਡੇ ਕੋਲੇਜ ਦਾ ਯੂਥ ਫੈਸਟੀਵਲ ਹੋ ਕੇ ਹਟਿਆ ਸੀ ਜਿਸ ਵਿੱਚ ਮੈਨੇ ਡਰੋਇੰਗ ਵਿੱਚ ਭਾਗ ਲਿਆ ਸੀ ਅਤੇ ਇਹ ਯੂਥ ਫੈਸਟੀਵਲ ਬਹੁਤ ਹੀ ਵਧੀਆ ਰਿਹਾ ਸੀ ਮੇਰਾ ਪਰ ਵਿੱਚ ਮੈਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਦੋਂ ਮੈਂ ਉੱਥੇ ਕੋਪੀਟੀਸ਼ਨ ਵਿੱਚ ਭਾਗ ਲੈ ਲਿਆ ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ਆਪਣਾ ਇੱਕ ਕਲਰ ਤਾਂ ਭੁੱਲ ਆਈ ਹਾਂ ਜਿਸ ਵਿੱ ਅ ਜਿਹੜਾ ਕਲਰ ਬਹੁਤ ਹੀ ਇੰਮਪੋਰਟੈਂਟ ਸੀਗਾ ਅਤੇ ਮੈਨੂੰ ਬਹਤੁ ਹੀ ਉਦੋਂ ਔਖਾ ਲੱਗਿਆ ਪਰ ਕਿਸੇ ਮੇਰੀ ਵਧੀਆ ਫਰੈਂਡ ਨੇ ਮੈਨੂੰ ਉਹ ਆਪਣਾ ਕਲਰ ਮੈਨੂੰ ਦੇ ਤਾ ਸੀ ਤਾਂ ਇਸ ਕਰਕੇ ਮੇਰਾ ਕੋਪੀਟੀਸ਼ਨ ਕਾਫ਼ੀ ਵਧੀਆ ਰਿਹਾ ਮੈਂ ਇਹ ਮੈਂ ਇਹ ਉਹ ਬਣਾ ਲਵਾਂਗੀ ਕਿ ਮੈਂ ਕੋਪੀਟੀਸ਼ਨ ਜਾਣ ਤੋਂ ਪਹਿਲਾਂ ਆਪਣਾ ਸਮਾਨ ਚੈੱਕ ਕਰਾਂ ਕਿ ਮੇਰੇ ਕੋਲ ਸਾਰਾ ਕੁਛ ਹੈ ਮੈਂ ਇਹ ਗਲ਼ਤੀ ਦੁਬਾਰਾ ਨਹੀਂ ਕਰਾਂਗੀ ਅਤੇ ਬਾਅਦ 'ਚੋਂ ਮੈਨੂੰ ਮੇਰਾ ਪ੍ਰਾਈਜ਼ ਫਸ ਸੈਕਿੰਡ ਪੁਜੀਸ਼ਨ 'ਤੇ ਆਇਆ ਸੀ ਤਾਂ ਮੈਂ ਬਹੁਤ ਖੁਸ਼ ਹੋਈ ਸੀ ਪਰ ਜੇ ਮੈਂ ਆਪਣੀ ਇਹ ਗ਼ਲਤੀ ਨਾ ਕਰਦੀ ਤਾਂ ਕਾ ਅ ਵੀ ਮੇਰਾ ਪ੍ਰਾਈਜ਼ ਫਸਟ ਪੁਜੀਸ਼ਨ 'ਤੇ ਆ ਜਾਂਦਾ ਅਤੇ ਮੇਰਾ ਇਹ ਡਰੋਇੰਗ ਦਾ ਜੋ ਮੇਰਾ ਪੈਸ਼ਨ ਹੈ ਮੈਂ ਇਹ ਚਾਹਾਂਗੀ ਕਿ ਮੈਂ ਇਸ ਨੂੰ ਛੱਡਾ ਨਾ ਆਪਣੇ ਕਰੀਅਰ ਕਰਕੇ ਜੇ ਮੈਂ ਚਾਹਾਂ ਜੇ ਮੈਂ ਚਾਹੁੰਗੀ ਤਾਂ ਮੈਂ ਆਪਣੇ ਡਰੋਇੰਗ ਨੂੰ ਆਪਣਾ ਕਮਾਈ ਦਾ ਰੁਜ਼ਗਾਰ ਵੀ ਬਣਾ ਲਵਾਂਗੀ ਅਤੇ ਮੇਰਾ ਡਰੋਇੰਗ ਦਾ ਮੇਰਾ ਮੇਰੀ ਡਰੋਇੰਗ ਵਿੱਚ ਇਨਟਰੱਸਟ ਹੋਣ ਕਰਕੇ ਮੈਂ ਕਾਫ਼ੀ ਸਾਰੇ ਮੈਨੂੰ ਓਪਸ਼ਨਸ ਵੀ ਆਉਂਦੇ ਨੇ ਜੋਬ ਦੇ ਅਤੇ ਮੈਂ ਆਪਣੀ ਡਰੋਇੰਗ ਦੀ ਇਸ ਇਨਟਰੱਸਟ ਵਿੱਚ ਇਸ ਨੂੰ ਕਦੇ ਨਹੀਂ ਛਡਾਂਗੀ